ਹਾਂ ਮੈਨੂੰ ਪਤਾ ਹੈ ਕਿ ਹੈਂਡ ਪੰਪ ਕਿਵੇਂ ਕੰਮ ਕਰਦਾ ਹੈ ਇਸ ਦੇ ਵਿਚਕਾਰ ਇੱਕ ਮੋਟੀ ਅਤੇ ਲੰਬੀ ਪਾਈਪ ਹੁੰਦੀ ਹੈ ਜਿਸ ਨਾਲ ਇੱਕ ਟੂਟੀ ਦਾ ਜੋੜ ਹੁੰਦਾ ਹੈ ਅਤੇ ਇਸ ਦੇ ਸਿਰ ਰਾਹੀਂ ਇੱਕ ਹੈਂਡਲ ਜਾਂ ਪੰਪ ਲੱਗਿਆ ਹੁੰਦਾ ਹੈ ਜਿਸ ਨੂੰ ਜਿਸ ਨਾਲ ਆਪਾਂ ਪਾਣੀ ਨੂੰ ਪਾਣੀ ਦਾ ਪ੍ਰੈਸ਼ਰ ਕਰਾਂਗੇ ਹੈਂਡਲ ਨਾਲ ਤਾਂ ਪਾਣੀ ਟੂਟੀ ਦੇ ਰਾਹੀਂ ਬਾਹਰ ਆਉਂਦਾ ਹੈ ਹਾਂ ਮੈਂ ਪੰਪ 'ਤੇ ਲੰਬੀਆਂ ਕਤਾਰਾਂ ਵੀ ਵੇਖੀਆਂ ਹਨ ਅਸੀਂ ਜਦੋਂ ਛੋਟੇ ਹੁੰਦੇ ਸੀ ਤਾਂ ਪਿੰਡ ਵਿੱਚ ਨਲਕੇ ਰਾਹੀਂ ਸਾਡੀ ਭਾਸ਼ਾ 'ਚ ਹੈਂਡ ਪੰਪ ਨੂੰ ਨਲਕਾ ਕਿਹਾ ਜਾਂਦਾ ਸੀ ਠੀਕ ਹੈ ਹੈਂਡ ਪੰਪ ਦੀਆਂ ਲੰਬੀਆਂ ਕਤਾਰਾਂ ਦਾ ਅਨੁਭਵ ਵੀ ਕੀਤਾ ਹੈ ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਅਸੀਂ ਹੈਂਡ ਪੰਪ ਦੁਆਰਾ ਹੀ ਪਾਣੀ ਭਰਦੇ ਸਨ ਇਹ ਕਈ ਵਾਰ ਗਰਮੀਆਂ ਵਿੱਚ ਖੁਸ਼ਕ ਵੀ ਹੁੰਦਾ ਹੈ ਪਰ ਇਸ ਦਾ ਪਾਣੀ ਪੀਣ ਵਿੱਚ ਬਹੁਤ ਸਵਾਦ ਹੁੰਦਾ ਹੈ